ਜਿਹੜੇ ਆਪਣੇ ਘਰਾਂ ਦੇ ਵਿੱਚ ਪੁਰਾਣੇ ਕੱਪੜੇ ਹੁੰਦੇ ਹਨ ਜਾਂ ਤਾਂ ਉਹਨਾਂ ਨੂੰ ਪੁਰਾਣੀਆਂ ਔਰਤਾਂ ਲੀਰਾਂ ਕਰਕੇ ਛੋਟੀਆਂ ਛੋਟੀਆਂ ਉਹਨਾਂ ਦੀਆਂ ਜਾਂ ਤਾਂ ਦਰੀਆਂ ਬੁਣ ਲੈਂਦੀਆਂ ਹੁੰਦੀਆਂ ਸਨ ਜਾਂ ਫਿਰ ਉਹਨਾਂ ਦਾ ਜਾਂ ਫਿਰ ਉਹਨਾਂ ਨੂੰ ਗੁੰਦ ਕੇ ਬਾਣ ਬਣਾ ਕੇ ਦਰੀਆਂ ਮੰਜੇ ਬੁਣ ਲੈਂਦੀਆ ਹੁੰਦੀਆਂ ਸਨ